ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਜਨਮਦਿਨ ਜਾਂ ਵਿਆਹ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ ਅਸੀਂ ਉਸ ਮੌਕੇ ਉਹਨਾਂ ਨੂੰ ਮਿਲਦੇ ਹਾਂ ਅਤੇ ਉਹਨਾਂ ਨੂੰ ਜਨਮਦਿਨ ਜਾਂ ਵਿਆਹ ਦੀ ਵਧਾਈ ਦਿੰਦੇ ਹਾਂ ਅਸੀਂ ਉਸ ਵਿਅਕਤੀ ਨੂੰ ਜਿਸ ਦਾ ਜਨਮਦਿਨ ਜਾਂ ਵਿਆਹ ਹੋਵੇ ਉਸ ਨੂੰ ਵਧਾਈ ਦਿੰਦੇ ਹਾਂ ਅਤੇ ਅੱਗੇ ਅੱਗੇ ਵਾਸਤੇ ਉਸ ਨੂੰ ਖੁਸ਼ ਰਹਿਣ ਲਈ ਦੁਆਵਾਂ ਵੀ ਦਿੰਦੇ ਹਾਂ ਅਤੇ ਕਿਉਂਕਿ ਵਿਆਹ ਜਾਂ ਜਨਮਦਿਨ ਸਾਲ ਵਿੱਚ ਇੱਕ ਵਾਰ ਹੀ ਆਉਂਦੇ ਹਨ ਜੋ ਕਿ ਸਾਕ ਸੰਬੰਧੀ ਦੋਸਤ ਮਿੱਤਰਾਂ ਆਦਿ ਨੂੰ ਇਕੱਠੇ ਹੋਣ ਲਿਆ ਮੌਕਾ ਦਿੰਦੇ ਹਨ ਅਤੇ ਅਸੀਂ ਬਹੁਤ ਹੀ ਜ਼ਿਆਦਾ ਖੁਸ਼ੀ ਨਾਲ ਕੋਈ ਵੀ ਪ੍ਰੋਗਰਾਮ ਹੋਵੇ ਉੱਥੇ ਨੱਚਦੇ ਹਾਂ ਗਾਉਂਦੇ ਹਾਂ ਟੱਪਦੇ ਹਾਂ ਅਤੇ ਖਾ ਖਾਣ ਖਾਣ ਸਬੰਧੀ ਕੋਈ ਵੀ ਵਸਤੂ ਹੋਵੇ ਉਸ ਨੂੰ ਅਨੰਦ ਤਰੀਕੇ ਨਾਲ